ਕੱਲ੍ਹ ਮੈਂ ਆਪਣੇ ਮਾਸੀ ਦੇ ਪਿੰਡ ਜਾਣਾ ਸੀ ਅਤੇ ਅਸੀਂ ਬਰਨਾਲੇ ਤੋਂ ਬੱਸ ਲੈ ਲਈ ਅਤੇ ਬੱਸ ਵਿਚ ਬਵੰਜਾ ਸੀਟਾਂ ਅਤੇ ਕੰਡਕਟਰ ਸੀ ਉਹਨਾਂ ਬੱਸ ਦੀਆਂ ਸੀਟਾਂ 'ਤੇ ਅਨੇਕਾਂ ਯਾਤਰੀ ਬੈਠੇ ਸੀ ਅਤੇ ਬੱਸ ਵਿੱਚ ਭੀੜ ਹੋਣ ਕਰਕੇ ਅਸੀਂ ਸੈਡ 'ਤੇ ਯਾਤਰੀ ਮਿਲ ਗਈ ਅਸੀਂ ਉੱਥੇ ਬੈਠ ਗਏ ਅਤੇ ਅਸੀਂ ਆਪਣੇ ਨਾਲ ਕੁਛ ਖਾਣ ਪੀਣ ਦਾ ਸਮਾਨ ਵੀ ਲੈ ਲਿਆ ਅਤੇ ਸਾਡੇ ਬੱਸ ਦਾ ਸਫ਼ਰ ਸਿਰਫ਼ ਦੋ ਘੰਟੇ ਦਾ ਦੋ ਘੰਟੇ ਦਾ ਸੀ ਅਤੇ ਅਸੀਂ ਉਸ ਸਫ਼ਰ ਨੂੰ ਦੋ ਘੰਟੇ ਵਿਚ ਤੈਅ ਕਰ ਲਿਆ ਅਤੇ ਬੱਸ ਅਨੇ ਬੱਸ ਅਨੇਕਾਂ ਪਿੰਡਾਂ ਵਿੱਚ ਜਾਂਦੀ ਵਿੱਚ ਦੀ ਜਾਂਦੀ ਹੈ ਅਤੇ ਦੋ ਤਿੰਨ ਅੱਡਿਆਂ ਵਿੱਚ ਵੀ ਰੁਕਦੀ ਹੈ ਅਤੇ ਬੱਸ ਬੱਸ ਵਿੱਚ ਸਫ਼ਰ ਕਰਨ ਦਾ ਅਲੱਗ ਅਲੱਗ ਮਨੋਰੰਜਨ ਹੁੰਦਾ ਹੈ ਬੱਸ ਵਿੱਚ ਅਨੇਕਾਂ ਯਾਤਰੀ ਹੀ ਦੂਰ ਦੁਰਾਡੇ ਤੋਂ ਆਉਂਦੇ ਹਨ ਅਤੇ ਉਹ ਦੂਰ ਦੁਰਾਡੇ ਦਾ ਸਫ਼ਰ ਤੈਅ ਕਰਦੇ ਹਨ ਆਪਸ ਵਿੱਚ ਅਤੇ ਨਾਲ ਕੁਛ ਖਾਣ ਪੀਣ ਦਾ ਸਮਾਨ ਵੀ ਰੱਖਦੇ ਹਨ ਅਤੇ ਤੀਰਥ ਸਥਾਨਾਂ 'ਤੇ ਵੀ ਜਾਣਾ ਹੁੰਦਾ ਤਾਂ ਕਿ ਲੋਕ ਕਈ ਯਾਤਰੀ ਬੱਸ 'ਤੇ ਸਫ਼ਰ ਕਰਦੇ ਹਨ ਬੱਸ ਦਾ ਸਫ਼ਰ ਲੰਬਾ ਹੁੰਦਾ ਹੈ ਅਤੇ ਪਰ ਆਰਾਮਦਾਇਕ ਹੁੰਦਾ ਹੈ ਬੱਸ ਵਿਚ ਸਫ਼ਰ ਕਰਨ ਨਾਲ ਮਤਲਬ ਆਪਣੇ ਸਰੀਰ ਨੂੰ ਤੰਦਰੁਸਤੀ ਮਹਿਸੂਸ ਹੁੰਦੀ ਹੈ ਆਪਾਂ ਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਪੂਰੇ ਸਵਸਥ ਹਾਂ ਅਤੇ ਬੱਸ ਵਿੱਚ ਰੈਸਟ ਕਰ ਸਕਦੇ ਹਾਂ ਅਤੇ ਬੱਸ ਵਿੱਚ ਯਾਤਰਾ ਤੈਅ ਕਰ ਸਕਦੇ ਹਾਂ ਕਿ ਕਾਲਜ ਟਾਈਮ ਵੀ ਬੱਚੇ ਬੱਸ ਦਾ ਸਫ਼ਰ ਤੈਅ ਕਰਦੇ ਹਨ ਅਤੇ ਬੱਸ ਦਾ ਸਫ਼ਰ ਤੈਅ ਕਰਨਾ ਵਧੀਆ ਮਹਿਸੂਸ ਹੁੰਦਾ ਹੈ ਬੱਸ ਦਾ ਸਫ਼ਰ ਸਿਰਫ਼ ਘੰਟੇ ਦੋ ਘੰਦੇ ਦਾ ਹੀ ਹੁੰਦਾ ਹੈ ਅਤੇ ਦੂਰ ਦੁਰਾਡੇ ਜਾਣ ਵਾਲੇ ਯਾਤਰੀਆਂ ਨੂੰ ਵੀ ਬੱਸ 'ਤੇ ਸਫ਼ਰ ਕਰਨ ਵਿੱਚ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਆਉਂਦੀ ਕਿਉਂਕਿ ਦੂਰ ਦੁਰਾਡੇ ਦੇ ਸਫ਼ਰ ਬੱਸ ਰਾਹੀਂ ਤੈਅ ਕਰਨ ਵਿਚ ਮੁਸ਼ਕਿਲ ਨਹੀਂ ਆਉਂਦੀ ਕਿਉਂਕਿ ਬੱਸ ਵਿੱਚ ਬੰਦਾ ਹਰ ਇਕ ਯਾਤਰੀ ਆਸਾਨੀ ਨਾਲ ਸਫ਼ਰ ਕਰ ਸਕਦਾ ਹੈ ਕਿਉਂਕਿ ਬੱਸ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੁੰਦੀ ਇਸ ਕਰਕੇ ਹਰ ਇੱਕ ਯਾਤਰੀ ਦੂਰ ਦੁਰਾਡੇ ਦੇ ਲੋਕ ਬੱਸ ਰਾਹੀਂ ਸਫ਼ਰ ਕਰਦੇ ਸਨ